ਭਾਰਤ ਵਿੱਚ ਡਾਂਸ ਅਤੇ ਡਾਂਸਰਾਂ ਦਾ ਬਹੁਤ ਹੀ ਪ੍ਰਭਾਵ ਪਿਆ ਹੈ ਜਿਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਬੋਲੀਵੁੱਡ ਵਿੱਚ ਵੀ ਬੋਲੀਵੁੱਡ ਵਿੱਚ ਹੀ ਪਿਆ ਹੈ ਜਿਸ ਵਿੱਚ ਲੋਕਾਂ ਨੂੰ ਬੋਲੀਵੁੱਡ ਸੌਂਗ ਬਾਲੀਵੁੱਡ ਗਾਣਿਆਂ 'ਤੇ ਡਾਂਸ ਕਰਨਾ ਬਹੁਤ ਹੀ ਪਸੰਦ ਹੈ ਲੋਕ ਅੱਜ ਕੱਲ੍ਹ ਡਾਂਸ ਬੋਲੀਵੁੱਡ ਗਾਣਿਆਂ 'ਤੇ ਹੀ ਕਰਦੇ ਹਨ ਬੋਲੀਵੁੱਡ ਵਿੱਚ ਵੀ ਕਈ ਸਾਰੇ ਐਸੇ ਐਕਟਰ ਅਤੇ ਸਿੰਗਰ ਹਨ ਜਿਹਨਾਂ ਨੂੰ ਡਾਂਸ ਕਰਨਾ ਬਹੁਤ ਹੀ ਪਸੰਦ ਹੈ ਅੱਜ ਕੱਲ੍ਹ ਤਾਂ ਬੋਲੀਵੁੱਡ ਵਿੱਚ ਪ੍ਰੋਫੈਸ਼ਨਲ ਸਿੰਗਰ ਪ੍ਰੋਫੈਸ਼ਨਲ ਡਾਂਸਰ ਆ ਗਏ ਹਨ ਜੋ ਕਿ ਬਹੁਤ ਹੀ ਵਧੀਆ ਡਾਂਸ ਕਰਦੇ ਹਨ ਅੱਜ ਕੱਲ੍ਹ ਦੇ ਡਾਂਸਰ ਤਾਂ ਜ਼ਿਆਦਾ ਰੈਪ ਸੌਂਗ 'ਤੇ ਹੀ ਡਾਂਸ ਕਰਦੇ ਹਨ ਜਿਹਨਾਂ ਜੋ ਕਿ ਉਹਨਾਂ ਨੂੰ ਬਹੁਤ ਹੀ ਪਸੰਦ ਹੈ ਅਤੇ ਲੋਕਾਂ ਨੂੰ ਦੇਖਣਾ ਵੀ ਬਹੁਤ ਹੀ ਪਸੰਦ ਹੁੰਦਾ ਹੈ ਭਾਰਤ ਵਿੱਚ ਤਾਂ ਐਸੇ ਕਈ ਸਾਰੇ ਗਾਣੇ ਹਨ ਜੋ ਕਿ ਲੋਕਾਂ ਨੂੰ ਬਹੁਤ ਪਸੰਦ ਹਨ ਪਰ ਸਭ ਤੋਂ ਜ਼ਿਆਦਾ ਲੋਕ ਅੱਜ ਲਤਾ ਮੰਗੇਸ਼ਕਰ ਜੀ ਦੇ ਗਾਣੇ ਹੀ ਸੁਣਨਾ ਪਸੰਦ ਕਰਦੇ ਹਨ ਅੱਜ ਕੱਲ੍ਹ ਦੇ ਬੱਚੇ ਜੋ ਬੱਚੇ ਹਨ ਜੋ ਕਿ ਅਰੀਜੀਤ ਸਿੰਘ ਨੇਹਾ ਕੱਕੜ ਆਦਿ ਦੇ ਗਾਣੇ ਸੁਣਨਾ ਪਸੰਦ ਕਰਦੇ ਹਨ ਜੋ ਕਿ ਬਹੁਤ ਹੀ ਸੋਹਣੇ ਹੁੰਦੇ ਹਨ ਅਤੇ ਉਹਨਾਂ ਨੂੰ ਬਹੁਤ ਹੀ ਪਸੰਦ ਹੁੰਦੇ ਹਨ ਪਰ ਪਹਿਲੇ ਜ਼ਮਾਨੇ ਦੇ ਲੋਕ ਅੱਜ ਵੀ ਲਤਾ ਮੰਗੇਸ਼ਕਰ ਜੀ ਦੇ ਗਾਣੇ ਪਸੰਦ ਕਰਦੇ ਹਨ ਕਈ ਬੱਚੇ ਤਾਂ ਅਜੇ ਵੀ ਐਸੇ ਹਨ ਜੋ ਕਿ ਪੁਰਾਣੇ ਸਿੰਗਰਾਂ ਨੂੰ ਹੀ ਸੁਣਨਾ ਪਸੰਦ ਕਰਦੇ ਹਨ ਅੱਜ ਕੱਲ੍ਹ ਤਾਂ ਬਹੁਤ ਸਾਰੇ ਬੱਚਿਆਂ ਅਤੇ ਵੱਡਿਆਂ ਨੂੰ ਵੀ ਰੈਪ ਸੌਂਗ ਜ਼ਿਆਦਾ ਪਸੰਦ ਆਉਂਦੇ ਹਨ